ਇੱਕੀ ਦਸੰਬਰ ਉੱਨੀ ਸੌ ਸਤੱਤਰ ਬਾਰਾਂ ਮਾਰਚ ਉੱਨੀ ਸੌ ਪੰਝੱਤਰ ਦੋ ਮਾਰਚ ਉੱਨੀ ਸੌ ਉਣਾਨਵੇਂ ਅੱਠ ਫਰਵਰੀ ਉੱਨੀ ਸੌ ਉਣੱਤਰ ਚਾਰ ਫਰਵਰੀ ਉੱਨੀ ਸੌ ਅਠੱਤਰ